ਸਾਡੇ ਖੇਤਰ ਦੇ ਵਿੱਚ ਹੈਲਥ ਕੇਅਰ ਸੈਂਟਰ ਹੀ ਬਹੁਤ ਅੱਜ ਕੱਲ ਐਡਵਾਂਸ ਹੋ ਚੁੱਕੇ ਹਨ ਅਤੇ ਆਧੁਨਿਕ ਹੋਣ ਕਰਕੇ ਬਹੁਤ ਹੀ ਵਧੀਆ ਹੋ ਗਏ ਹਨ ਜਿਹਦੇ ਕਰਕੇ ਸਾਨੂੰ ਹਰ ਇੱਕ ਤਰੀਕੇ ਦੀ ਦਵਾਈ ਹਾ ਸਾਡੇ ਹੈਲਥ ਕੇਅਰ ਸੈਂਟਰ ਤੋਂ ਹੀ ਮਿਲ ਜਾਂਦੀ ਹੈ ਵੱਡ ਉਹ ਵੱਡੀ ਛੋਟੀ ਤੋਂ ਛੋਟੀ ਜਿਹਦੇ ਕਰਕੇ ਸਾਡੇ ਸਾਡੇ ਹਰ ਇੱਕ ਤਰੀਕੇ ਦੇ ਗੱਲਾਂ ਅਤੇ ਸਾਡੇ ਹਰ ਇੱਕ ਤਰੀਕੇ ਦੀਆਂ ਪ੍ਰੋਬਲਮਾਂ ਨੂੰ ਸੁਣਿਆ ਜਾਂਦਾ ਹੈ ਜਿੱਥੇ ਕਿ ਸਾਡੇ ਹਰ ਇੱਕ ਦ ਪ੍ਰੋਬਲਮ ਜਾਂ ਰੋਗ ਦਾ ਇਲਾਜ ਹੁੰਦਾ ਹੈ ਜਿੱਥੇ ਜੇ ਤੇ ਅਸੀਂ ਉਹ ਇੱਕ ਇਹੋ ਜਿਹਾ ਸੈਂਟਰ ਹੋ ਗਿਆ ਹੈ ਜਿੱਥੇ ਕਿ ਪਹਿਲੇ ਤਾਂ ਕੁਝ ਵੀ ਨਹੀਂ ਸੀ ਅੱਜ ਕੱਲ ਹਰ ਇੱਕ ਤਰੀਕੇ ਦੇ ਰੋਗਾਂ ਦੀ ਦਵਾਈਆਂ ਹਨ ਅਤੇ ਹ ਇੱਕ ਇੱਹੋ ਜਿਹੀ ਮੈਡੀਕਲ ਟੀਮ ਹੈ ਜਿਹਦੇ ਕਰਕੇ ਸਾਡੇ ਰੋਗਾਂ ਨੂੰ ਚੰਗੇ ਤਰੀਕੇ ਨਾਲ ਦੇਖਿਆ ਜਾਂਦਾ ਹੈ ਅਤੇ ਦੇਖ ਕੇ ਅਤੇ ਉਹਦੇ ਹੀ ਦੌਰਾਨ ਸਾਡੇ ਸਰੀਰ ਦੇ ਦੌਰਾਨ ਹੀ ਸਾਡੇ ਸਰੀਰ ਦੇ ਰੋਗ ਦੇ ਦੌਰਾਨ ਹੀ ਦਵਾਈ ਦਿੱਤੀ ਜਾਂਦੀ ਹੈ ਇਸ ਕਰਕੇ ਸਾਨੂੰ ਆਪਣੇ ਰੋਗਾਂ ਨੂੰ ਦੂਰ ਕਰਨ ਵਾਸਤੇ ਸਾਡੇ ਹੈਲਪਲਾਈਨ ਸੈਂਟਰ ਵੱਲ ਜਾਣਾ ਚਾਹੀਦਾ ਹੈ